ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਤੁਸੀਂ ਓਲਾ ਤੋਂ ਬੋਲ ਰਹੇ ਹੋ ਜੀ ਧੰਨਵਾਦ ਮੇਰਾ ਨਾਮ ਲੱਕੀ ਹੈ ਅਤੇ ਮੈਂ ਅੱਧੇ ਘੰਟੇ ਪਹਿਲੇ ਆਪਣੀ ਇੱਕ ਰਾਈਡ ਬੁੱਕ ਕੀਤੀ ਸੀ ਹਾਂਜੀ ਓਲਾ ਐਪ ਨੇ ਤੁਹਾਨੂੰ ਹੀ ਉਹਦਾ ਡਰਾਈਵਰ ਅਸਾਈਨ ਕੀਤਾ ਹੋਇਆ ਅੱਛਾ ਠੀਕ ਮੈਂ ਵੇਖ ਰਿਹਾ ਸੀ ਅੱਧਾ ਘੰਟਾ ਹੋ ਗਿਆ ਐਕਚੁਲੀ ਤੁਸੀਂ ਆਏ ਨਹੀਂ ਸੀ ਅਤੇ ਇਸ ਲਈ ਮੈਂ ਪੁੱਛਣਾ ਸੀ ਤੁਹਾਨੂੰ ਹਲੇ ਕਿੰਨਾਂ ਕੁ ਟਾਈਮ ਲੱਗੇਗਾ ਆਉਣ 'ਚ ਠੀਕ ਹੈ ਓਕੇ ਹਾਂ ਮੈਨੂੰ ਕਿਉਂਕਿ ਕਾਫੀ ਸਮੇਂ ਹੋ ਗਿਆ ਉਡੀਕਦੇ ਹੋਏ ਇਸ ਕਰਕੇ ਮੈਂ ਪੁੱਛਿਆ ਕਿ ਤੁਸੀਂ ਕਿਹਦੇ ਕਰਕੇ ਹੈਗੇ ਹੋ ਉਂਝ ਇਸ ਵੇਲੇ ਤੁਸੀਂ ਕਿੱਥੇ ਕਰਕੇ ਹੈਗੇ ਹੋ ਠੀਕ ਹੈ ਰਤਨ ਸਿੰਘ ਚੌਂਕ ਲਾਗੇ ਠੀਕ ਹੈ ਮੈਂ ਉਂਝ ਇੱਥੇ ਕਿ ਰਣਜੀਤ ਐਵੀਨਿਊ ਖਲੋਤਾ ਹੋਇਆ ਤੁਸੀਂ ਕਿੰਨੇ ਕੁ ਚਿਰ ਤੱਕ ਆ ਜਾਓਗੇ ਠੀਕ ਹੈ ਆ ਰਣਜੀਤ ਐਵੀਨਿਊ ਜਿਹੜਾ ਐੱਮ ਕੇ ਹੋਟਲ ਹੈਗਾ ਆ ਉਸ ਦੇ ਲਾਗੇ ਮੈਂ ਖਲੋਤਾ ਹੋਇਆ ਹਾਂ ਹਾਂ ਖਾਲਸਾ ਕੋਲੇਜ ਦਾ ਜਿਹੜਾ ਗੇਟ ਹੈਗਾ ਉਹਦੇ ਬਿਲਕੁਲ ਸਾਹਮਣੇ ਹੀ ਮੈਂ ਖਲੋਤਾ ਹੈਗਾ ਖਾਲਸਾ ਕੋਲੇਜ ਦੇ ਗੇਟ ਦੇ ਹਾਂ ਤੁਸੀਂ ਆ ਕੇ ਮੈਨੂੰ ਇੱਧਰ ਰਸੀਵ ਕਰ ਲਿਓ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਇਸ ਕਰਕੇ ਮੈਂ ਤੁਹਾਨੂੰ ਕੌਲ ਕੀਤਾ ਕੋਸ਼ਿਸ਼ ਕਰੋ ਕਿ ਜਲਦੀ ਆ ਜੋ ਮੈਨੂੰ ਵੀ ਆਪਣੇ ਗੰਤਵ 'ਤੇ ਛੇਤੀ ਤੋਂ ਛੇਤੀ ਪਹੁੰਚਣਾ ਹੈ ਠੀਕ ਧੰਨਵਾਦ